ਜ਼ਿਆਦਾਤਰ ਅੱਜ ਦੇ ਸਮੇਂ ਵਿੱਚ ਖਾਣਾ ਬਣਾਉਣ ਲਈ ਐੱਲ ਪੀ ਜੀ ਗੈਸ ਸਿਲੰਡਰਾਂ ਦੀ ਵਰਤੋਂ ਹੋਣ ਲੱਗ ਪਈ ਹੈ ਇਸ ਸਮੇਂ ਵਿੱਚ ਇਹ ਸਮੇਂ ਦੀ ਵੀ ਬੱਚਤ ਹੁੰਦੀ ਹੈ ਅਤੇ ਖਾਣਾ ਵੀ ਜਲਦੀ ਬਣਦਾ ਹੈ ਕਿੰਤੂ ਇਹਨਾਂ ਸਿਲੰਡਰਾਂ ਦੀ ਵਰਤੋਂ ਬੜੀ ਸਾਵਧਾਨੀ ਨਾਲ਼ ਕਰਨੀ ਚਾਹੀਦੀ ਹੈ ਕਿਉਂਕਿ ਅਗਰ ਸਾਵਧਾਨੀ ਨਹੀਂ ਵਰਤਦੇ ਤਾਂ ਕੋਈ ਦੁਰਘਟਨਾ ਵੀ ਹੋ ਸਕਦੀ ਹੈ ਇਸ ਲਈ ਹਮੇਸ਼ਾ ਸਿਲੰਡਰ ਨੂੰ ਖਾਣਾ ਬਣਾਉਣ ਵਾਲੀ ਥਾਂ ਤੋਂ ਥੋੜ੍ਹੀ ਦੂਰ ਰੱਖੋ ਅਤੇ ਖਾਣਾ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਿਲੰਡਰ ਗੈਸ ਪਾਈਪ ਦੀ ਜਾਂਚ ਕਰੋ ਸਿਲੰਡਰ ਨੂੰ ਧੁੱਪ ਵਾਲੀ ਥਾਂ ਤੋਂ ਦੂਰ ਰੱਖੋ ਕਿਉਂਕਿ ਧੁੱਪ ਵਿੱਚ ਗੈਸ ਗੈਸ ਪਾਈਪ ਜਲਦੀ ਖਰਾਬ ਹੋ ਜਾਂਦੀ ਹੈ ਅਤੇ ਖਾਣਾ ਬਣਾਉਣ ਤੋਂ ਬਾਅਦ ਸਿਲੰਡਰ ਨੂੰ ਬੰਦ ਕਰ ਦਿਓ ਇਹਨਾਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਖਾਣਾ ਬਣਾਉਣਾ ਚਾਹੀਦਾ ਹੈ